ਅਸੀਂ ਧੋਆ ਧਾਰਮਿਕ ਮੌਕਿਆਂ ਦਾ ਮਤਲਬ ਦੇਵਤਿਆਂ ਦੀ ਕਦੀ ਮੂਰਤੀਆਂ ਨਹੀਂ ਬਣਾਈਆਂ ਹਨ ਕਿਉਂਕਿ ਸਾਡੇ 'ਚ ਰਿਵਾਜ਼ ਨਹੀਂ ਹੈਗਾ ਇਹ ਚੀਜ਼ ਦਾ ਇਹ ਹਿੰਦੂ ਧਰਮ ਨੂੰ ਮਤਲਬ ਹਿੰਦੂ ਧਰਮ ਵਿੱਚ ਹੈਗਾ ਹੈ ਜੋ ਕਿ ਗਣੇਸ਼ ਜੀ ਦੀ ਮੂਰਤੀ ਨੂੰ ਬਣਾਇਆ ਜਾਂਦਾ ਹੈ ਫਿਰ ਉਹਨਾਂ ਨੂੰ ਘਰ ਸਥਾਪਿਤ ਕੀਤਾ ਜਾਂਦਾ ਹੈ ਫਿਰ ਉਹਨਾਂ ਨੂੰ ਉਹਨਾਂ ਦੀ ਪੂਜਾ ਵਗੈਰਾ ਕੀਤੀ ਜਾਂਦੀ ਹੈ ਫਿਰ ਜਦੋਂ ਉਹਨਾਂ ਦਾ ਮਤਲਬ ਪੂਜਾ ਵਗੈਰਾ ਹੋ ਜਾਂਦੀ ਹੈ ਤਾਂ ਉਹਨਾਂ ਨੂੰ ਫਿਰ ਜਲ ਪ੍ਰਵਾਹ ਕੀਤਾ ਜਾਂਦਾ ਹੈ ਇਹ ਸਿਰਫ ਹਿੰਦੂ ਧਰਮ ਵਿੱਚ ਹੀ ਮੂਰਤੀਆਂ ਬਣਾਈਆਂ ਜਾਂਦੀਆਂ ਹਨ ਜਾਂ ਵੇਚੀਆਂ ਜਾਂਦੀਆਂ ਹਨ ਤਾਂ ਫਿਰ ਇਹੀ ਚੀਜ਼ ਜਿਹੜੀ ਹੈ ਹਿੰਦੂ ਧਰਮ ਵਿੱਚ ਅੱਗੇ ਅਨੁਭਵ ਕਰਦੀ ਰਹਿੰਦੀ ਹੈ